ਸਾਡੇ ਪੰਜਾਬ ਵਿੱਚ ਦਰਿਆ ਨਾਲ ਵੰਡਿਆ ਹੋਇਆ ਖੇਤਰ ਮਾਝਾ ਮਾਲਵਾ ਦੁਆਬਾ ਇਹ ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਤਰੀਕੇ ਨਾਲ ਅਲੱਗ ਅਲੱਗ ਲੋਕ ਗੀਤ ਗਾਏ ਜਾਂਦੇ ਨੇ ਜਿਵੇਂ ਕਿ ਮੈਂ ਕੁਝ ਤੁਹਾਨੂੰ ਦੱਸਦਾ ਹਾਂ ਜਿਵੇਂ ਕਿ ਘੋੜੀਆਂ ਸੁਹਾਗ ਸਿੱਠਣੀਆਂ ਛੰਦ ਪਰਾਗਾ ਛੱਲਾ ਟੱਪੇ ਬੋਲੀਆਂ ਆਦਿ ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਤਰੀਕੇ ਨਾਲ ਗਾਈਆਂ ਜਾਂਦੀਆਂ ਨੇ ਜਿਵੇਂ ਮੈਂ ਤੁਹਾਨੂੰ ਇੱਕ ਲੋਕ ਗੀਤ ਸੁਣਾਵਾਂ ਜਿਵੇਂ ਕਿ ਚੇਤਰ ਨਾ ਜਾਈਂ ਚੰਨਾ ਖਿੜੀ ਬਹਾਰ ਵੇ ਚੇਤਰ ਨਾ ਜਾਈਂ ਚੰਨਾ ਖਿੜੀ ਬਹਾਰ ਵੇ ਵਿਸਾਖ ਨਾ ਜਾਈਂ ਚੰਨਾ ਚੰਬਾ ਮੌਲਿਆ ਮਤਲਬ ਇੱਦਾਂ ਦੇ ਅਲੱਗ ਅਲੱਗ ਤਰੀਕੇ ਨਾਲ ਅਲੱਗ ਅਲੱਗ ਜਿਹੜੇ ਨੇ ਲੋਕ ਗੀਤ ਗਾਏ ਜਾਂਦੇ ਨੇ ਅਤੇ ਤੁਹਾਨੂੰ ਇੱਕ ਸੁਹਾਗ ਸੁਣਾਨਾ ਉਹਦੀ ਮੈਨੂੰ ਪਹਿਲੀ ਲਾਈਨ ਯਾਦ ਆ ਜਿਵੇਂ ਕਿ ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ ਇਹ ਅਲੱਗ ਤਰੀਕੇ ਨਾਲ ਮਤਲਬ ਵਿਆਹ ਦੇ ਸਮੇਂ ਗਾਈ ਜਾਂਦੀ ਆ ਅਤੇ ਇਹ ਹਰ ਇੱਕ ਸਮਾਂ ਦੇ ਹਿਸਾਬ ਨਾਲ ਹਰ ਇੱਕ ਜਗ੍ਹਾ ਦੇ ਹਿਸਾਬ ਨਾਲ ਇਹ ਗਾਏ ਜਾਂਦੇ ਆ ਬਸ